ਬਚਪਨ ਤੋਂ ਹੀ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਇਹੀ ਗਾਉਣ ਦਾ ਮੌਕਾ ਮੈਨੂੰ ਇੱਕ ਵਾਰ ਸਕੂਲ 'ਚ ਵੀ ਮਿਲਿਆ ਅਤੇ ਸਕੂਲ ਦੇ ਸਲਾਨਾ ਪ੍ਰੋਗਰਾਮ ਵਿੱਚ ਮੈਡਮ ਨੇ ਜਦ ਮੈਨੂੰ ਗਾਉਣ ਲਈ ਕਿਹਾ ਤਾਂ ਮੈਂ ਉੱਥੇ ਦਰਸ਼ਕਾਂ ਦੀ ਭੀੜ ਦੇਖ ਕੇ ਘਬਰਾ ਗਈ ਲੇਕਿਨ ਮੇਰੀ ਮੈਡਮ ਨੇ ਮੈਨੂੰ ਪ੍ਰੇਰਣਾ ਦਿੱਤੀ ਅਤੇ ਉਨਾਂ ਦੀ ਪ੍ਰੇਰਨਾ ਸਦਕਾ ਮੈਂ ਉਸ ਸਮੇਂ ਬਹੁਤ ਵਧੀਆ ਗੀਤ ਗਾਇਆ ਅਤੇ ਉਸ ਸਮੇਂ ਗੀਤ ਗਾਉਣ ਸਮੇਂ ਮੈਨੂੰ ਫਿਰ ਕੋਈ ਘਬਰਾਹਟ ਨਹੀਂ ਹੋਈ ਅਤੇ ਆਉਣ ਵਾਲੇ ਸਮੇਂ 'ਚ ਵੀ ਮੈਨੂੰ ਕੋਈ ਘਬਰਾਹਟ ਨਹੀਂ ਹੋਈ